ਅੱਜ ਦੇ ਸਮੇਂ ਦੇ ਵਿੱਚ ਟੈਕਲੋ ਟੈਕਨੋਲਜੀ ਕਾਰਨ ਸਾਰੇ ਕੰਮ ਬਹੁਤ ਸੌਖੇ ਹੋ ਗਏ ਹਨ ਕਿਉਂਕਿ ਪਹਿਲਾਂ ਦੇ ਸਮੇਂ ਦੇ ਵਿੱਚ ਲੋਕਾਂ ਕੋਲ ਫ਼ੋਨ ਨਹੀਂ ਹੁੰਦੇ ਸੀਗੇ ਅਤੇ ਲੋਕ ਹੱਥਾਂ ਨਾਲ਼ ਚਿੱਠੀਆਂ ਲਿਖ ਲਿਖ ਕੇ ਭੇਜਦੇ ਸੀਗੇ ਅਤੇ ਚਿੱਠੀਆਂ ਵੀ ਘੱਟੋ ਘੱਟ ਦਸ ਪੰਦਰਾਂ ਦਿਨ ਪਹਿਲਾਂ ਦਸ ਦਿਨ ਦਸ ਪੰਦਰਾਂ ਦਿਨ ਬਾਅਦ 'ਚ ਪਹੁੰਚਦੀਆਂ ਹਨ ਚਾਹੇ ਬੰਦਾ ਜਿੱਥੇ ਮਰਜ਼ੀ ਬੈਠਾ ਹੋਵੇ ਪਰ ਅੱਜ ਦੇ ਸਮੇਂ ਦੇ ਵਿੱਚ ਫ਼ੋਨ ਦੇ ਕਾਰਨ ਲੋਕ ਫ਼ੋਨ ਕਰ ਕਰਦੇ ਹਨ ਅਤੇ ਉਹਨਾਂ ਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਅੱਜ ਦੇ ਸਮੇਂ ਦੇ ਵਿੱਚ ਲੋਕ ਵੀਡੀਓ ਕੋਲ ਵੀ ਕਰ ਸਕਦੇ ਹਨ ਮੈਸੇਜ ਕਰ ਸਕਦੇ ਹਨ ਜਿਨ੍ਹਾਂ ਕੋਲ ਜਿਨ੍ਹਾਂ ਕਾਰਨ ਉਹ ਗੱਲਾਂ ਕਰਦੇ ਹਨ ਅਤੇ ਅੱਜ ਦੇ ਸਮੇਂ ਦੇ ਵਿੱਚ ਇੱਦਾਂ ਦੀਆਂ ਕਈ ਟੈਕਨੋਲੋਜੀਆਂ ਆ ਗਈਆਂ ਹਨ ਅਤੇ ਜਿਹੜਾ ਜਿਨ੍ਹਾਂ ਨੇ ਲੋਕਾਂ ਦਾ ਬਹੁਤ ਸਾਰਾ ਕੰਮ ਮਤਲਬ ਸੌਖਾ ਕਰ ਦਿੱਤਾ ਹੈ ਅਤੇ ਅਤੇ ਮਤਲਬ ਏਦਾਂ ਦੀ ਟੈਕਨੋਲਜੀ ਆ ਗਈ ਹੈ ਕਿ ਮਤਲਬ ਕਿ ਮਨੁੱਖ ਨੂੰ ਬਹੁਤ ਸਹਾਇਤਾ ਮਿਲਦੀ ਹੈ ਅਤੇ ਜਿਵੇਂ ਕਿ ਗੱਲ ਕਰੀਏ ਰਸੋਈ ਦੀ ਤਾਂ ਰਸੋਈ ਦੇ ਵਿੱਚ ਫਰਿੱਜ਼ ਮਾਈਕ੍ਰੋਵੇਵ ਹੁੰਦਾ ਹੈ ਅਤੇ ਜਿਸ ਕਾਰਨ ਫਰਿੱਜ਼ ਵਿੱਚ ਮਤਲਬ ਲੋਕ ਚੀਜ਼ਾਂ ਖ਼ਰਾਬ ਹੋਣ ਤੋਂ ਰੱਖਦੇ ਹਨ ਠੰਡੀਆਂ ਚੀਜ਼ਾਂ ਰੱਖਦੇ ਹਨ ਅਤੇ ਮਾਈਕ੍ਰੋਵੇਵ ਦੇ ਵਿੱਚ ਲੋਕ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਬਣਾਉਂਦੇ ਹਨ ਅਤੇ ਮਤਲਬ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦਾ ਖਾਣ ਪੀਣ ਵਾਸਤੇ ਆਨੰਦ ਲੈਂਦੇ ਹਨ ਅਤੇ ਅੱਜ ਦੇ ਟਾਈਮ ਦੇ ਵਿੱਚ ਇੱਦਾਂ ਦੀਆਂ ਕਈ ਟੈਕਨੋਲਜੀਆਂ ਹਨ ਕਿ ਲੋਕਾਂ ਨੇ ਆਪਣੇ ਪੁਰਾਣੇ ਕੰਮ ਛੱਡ ਕੇ ਮਸ਼ੀਨਾਂ ਵੱਲ ਤੁਰ ਪਏ ਹਨ ਅਤੇ ਜਿਵੇਂ ਕਿ ਫੈਕਟਰੀ ਦੇ ਵਿੱਚ ਲੇਬਰਾਂ ਦੀ ਵੀ ਘਾਟ ਮਤਲਬ ਪਹਿਲਾਂ ਬਹੁਤ ਹੁੰਦੀ ਸੀਗੀ ਪਰ ਹੁਣ ਮਸ਼ੀਨਾਂ ਮਸ਼ੀਨਾਂ ਕਰਕੇ ਮਤਲਬ ਸਾਰੇ ਕੰਮ ਅੱਧੇ ਅੱਧੇ ਕੰਮ ਮਸ਼ੀਨਾਂ ਦੇ ਨਾਲ਼ ਏ ਹੋ ਜਾਂਦੇ ਹਨ ਅਤੇ ਲੇਬਰਾਂ ਦੀ ਵੀ ਘੱਟ ਮਤਲਬ ਲੋੜ ਨਹੀਂ ਪੈਂਦੀ ਹਨ ਜਿਸ ਕ ਜਿਸ ਕਾਰਨ ਮਸ਼ੀਨਾਂ ਹੀ ਸਾਰੇ ਕੰਮ ਉਹਨਾਂ ਦੇ ਕਰ ਦਿੰਦੀਆਂ ਹਨ